ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਤਿਉਹਾਰ ਸ਼ੁਰੂ ਹੋ ਜਾਂਦੇ ਨੇ ਮੰਨ ਲਓ ਦਿਵਾਲੀ ਦਾ ਤਾਂ ਉੱਥੇ ਜਿਹੜੇ ਲੋਕਲ ਨੇ ਸਾਡੇ ਲੋਕਲ ਲੋਕ ਬੈਠੇ ਨੇ ਜਿਵੇਂ ਭਾਂਡੇ ਬਣਾਉਣ ਵਾਲੇ ਘੁਮਿਆਰ ਹੋ ਗਏ ਤਾਂ ਮੂਰਤੀ ਸਾਜ ਹੋ ਗਏ ਜਾਂ ਆਪਣੇ ਫੋਟੋਆਂ ਬਣਾਉਣ ਵਾਲੇ ਹੋ ਗਏ ਇਹ ਕੀ ਕਰਦੇ ਨੇ ਇਹਨਾਂ ਨੂੰ ਇਹ ਹਰੇਕ ਤਿਉਹਾਰ ਦੇ ਉੱਪਰ ਆਪਣੀਆਂ ਦੇਵਤਿਆਂ ਦੀਆਂ ਮੂਰਤੀਆਂ ਵੇਚਦੇ ਨੇ ਅਲੱਗ ਅਲੱਗ ਤਿਉਹਾਰ ਦੇ ਉੱਪਰ ਇਹ ਬਹੁਤ ਵਧੀਆ ਚੀਜ਼ ਆ ਅਸੀਂ ਤਾਂ ਖੈਰ ਨਹੀਂ ਬਣਾਈਆਂ ਕਦੇ ਆਪਾਂ ਹਰੇਕ ਬੰਦਾ ਮੂਰਤੀਸਾਜ ਨਹੀਂ ਹੁੰਦਾ ਪਰ ਜਿਹੜੇ ਵਜਦੇ ਨੇ ਉਹਨਾਂ ਦਾ ਬਹੁਤ ਵਧੀਆ ਰੁਜ਼ਗਾਰ ਚੱਲਦਾ ਉਹਨਾਂ ਨੂੰ ਕਮਾਈ ਹੁੰਦੀ ਆ ਉਹਨਾਂ ਦੀ ਕਮਾਈ 'ਚ ਵਾਧਾ ਹੁੰਦਾ ਚੱਲੋ ਉਹਨਾਂ ਦਾ ਟਾਈਮ ਪਾਸ ਵਧੀਆ ਹੁੰਦਾ ਇਹ ਚੀਜ਼ ਨਾਲ ਪਰ ਮਿਹਨਤ ਵੀ ਬੜੀ ਕਰਦੇ ਨੇ ਜਿਵੇਂ ਆਪਾਂ ਦੇਖਦੇ ਹਾਂ ਵੀ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲਵੇ ਘੁਮਿਆਰ ਬੈਠੇ ਨੇ ਉਹ ਘੜੇ ਵਗੈਰਾ ਬਣਾਉਂਦੇ ਨੇ ਅਤੇ ਉਹ ਮੂਰਤੀਆਂ ਹੀ ਬਣਾਉਂਦੇ ਨੇ ਨਾਲ ਨਾਲ ਤਾਂ ਮੂਰਤੀਆਂ ਬੜੀਆਂ ਸੋਹਣੀਆਂ ਦੇਵਤਿਆਂ ਦੀਆਂ ਦੇਵੀਆਂ ਦੀਆਂ ਬਣਾਉਂਦੇ ਨੇ ਲੋਕਾਂ ਲਈ ਜਿਵੇਂ ਆਪ ਵਰਤ ਆਉਂਦੇ ਨੇ ਵਰਤਾਂ ਵੇਲੇ ਵੀ ਬਣਾਉਂਦੇ ਨੇ ਮੂਰਤੀਆਂ ਉਹ ਦੇ ਕੇ ਆਉਂਦੇ ਨੇ ਘਰਾਂ ਦੇ ਵਿੱਚ ਇਹ ਅਨੁਭਵ ਦੇਖਿਆ ਸੀ ਕੋਲੋਂ ਦੇਖਿਆ ਬਿਲਕੁਲ ਬਣਾਉਂਦੇ ਸਾਡੇ ਘਰਾਂ ਕੋਲ ਪਹਿਲਾਂ ਬਣਾਏ ਜਾਂਦੇ ਸੀਗੇ ਪੇਂਡੂ ਖੇਤਰ ਦੇ ਵਿੱਚ ਅਸੀਂ ਦੇਖਦੇ ਹਾਂ ਅਤੇ ਇਹ ਲੋਕ ਬਹੁਤ ਮਿਹਨਤ ਕਰਕੇ ਮੂਰਤੀਆਂ ਬਣਾਉਂਦੇ ਨੇ ਦੇਵੀ ਦੇਵਤਿਆਂ ਦੀਆਂ ਅਸੀਂ ਦੇਖਦੇ ਹਾਂ ਅਲੱਗ ਅਲੱਗ ਥਾਂ 'ਤੇ ਬਣਦੀਆਂ ਨੇ ਤਾਂ ਬਹੁਤ ਵਧੀਆ ਚੀਜ਼ ਹੈ ਇਹ ਇਹਨਾਂ ਨਾਲ ਕੀ ਹੁੰਦਾ ਤਿਉਹਾਰ ਦੇ ਆਉਣ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਕਿਉਂਕਿ ਦੋ ਮਹੀਨੇ ਇਹਨਾਂ ਦਾ ਪਹਿਲਾਂ ਗੱਲ ਕੰਮ ਚੱਲ ਪੈਂਦਾ ਦੋ ਤਿੰਨ ਮਹੀਨੇ ਕੁਛ ਬਾਅਦ 'ਚ ਚੱਲੀ ਜਾਂਦਾ ਤਾਂ ਇਹ ਬਹੁਤ ਵਧੀਆ ਚੀਜ਼ ਆ ਮੂਰਤੀ ਬਣਾਉਣਾ ਮਾੜੀ ਚੀਜ਼ ਨਹੀਂ ਵਧੀਆ ਚੀਜ਼ ਆ